ਹੈਲੋ ਸਰ ਤੁਸੀਂ ਐਮਾਜੋਨ ਕੰਪਨੀ ਤੋਂ ਗੱਲ ਕਰ ਰਹੇ ਹੋ ਸਰ ਮੈਂ ਐਮਾਜ਼ਨ ਕੰਪਨੀ ਤੋਂ ਇੱਕ ਪ੍ਰੋਡਕਟ ਪਰਚੇਸ ਕੀਤਾ ਸੀਗਾ ਉਹਦਾ ਔਡਰ ਨੰਬਰ ਹੈਗਾ ਆ ਥ੍ਰੀ ਸੈਵਨ ਏਟ ਸਿਕਸ ਟੂ ਜ਼ੀਰੋ ਈ ਵੰਨ ਫੋਰ ਥ੍ਰੀ ਏਟ ਫੋਰ ਜ਼ੀਰੋ ਸਰ ਇਹ ਔਡਰ ਨੰਬਰ ਹੈਗਾ ਆ ਪ੍ਰੋਡਕਟ ਦਾ ਅਤੇ ਮੈਂ ਐੱਮ ਸਾਈਜ 'ਚ ਜਿਹੜੀ ਕੁੜਤੀ ਹੈ ਉਹ ਪਰਚੇਜ ਕੀਤੀ ਸੀਗੀ ਅਤੇ ਸਰ ਇਹਨਾਂ ਨੇ ਮੈਨੂੰ ਕਿਹਾ ਲਿਖਿਆ ਹੋਇਆ ਸੀ ਮੈਂਸ਼ਨ ਕੀਤਾ ਹੋਇਆ ਸੀ ਕਿ ਚੌਦਾਂ ਤਰੀਕ ਨੂੰ ਤੁਹਾਡਾ ਜਿਹੜਾ ਪ੍ਰੋਡਕਟ ਉਹ ਡਿਲੀਵਰ ਹੋ ਜਾਵੇਗਾ ਪਰ ਉਹਨਾਂ ਉਹ ਚੌਦਾਂ ਤਰ ਤਰੀਕ ਤੋਂ ਡਿਲੇ ਹੋਇਆ ਮੈਨੂੰ ਮੇਰਾ ਪ੍ਰੋਡਕਟ ਅਤੇ ਸਰ ਜਦੋਂ ਮੈਂ ਪ੍ਰੋਡਕਟ ਖੋਲ੍ਹਿਆ ਤਾਂ ਉਹ ਜਿਸ ਜਿਸ ਤਰ੍ਹਾਂ ਦਾ ਦਿਖਾਇਆ ਗਿਆ ਸੀ ਉਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਸੀ ਜਿਹੜਾ ਉਹਦਾ ਕਲਰ ਹੈ ਉਹ ਸਾਰਾ ਫੇਟ ਹੋਇਆ ਹੋਇਆ ਸੀਗਾ ਅਤੇ ਜਿਹੜਾ ਪ੍ਰੋਡਕਟ ਦਾ ਕਲਰ ਆ ਉਹ ਫੇਟ ਹੋਇਆ ਹੋਇਆ ਸੀ ਜਿਹੜਾ ਪ੍ਰੋਡਕਟ ਦਾ ਮਟੀਰੀਅਲ ਹੈ ਉਹ ਵ ਉਹ ਵਿੰ ਤਾਂ ਉੱਥੇ ਵਿੰਟਰ ਦਾ ਦਿਖਾਇਆ ਹੋਇਆ ਸੀ ਅਤੇ ਉਹ ਸਮਰ ਦਾ ਨਿਕਲਿਆ ਇਸ ਲਈ ਜਿਹੜੇ ਮੇਰੇ ਪੈਸੇ ਸੀਗੇ ਸਰ ਉਹ ਵੀ ਖਰਾਬ ਹੋ ਗਏ ਹੈ ਨਾ ਅਤੇ ਅਤੇ ਮੈਂ ਹੁਣ ਇਹ ਪ੍ਰੋਡਕਟ ਰਿਟਰਨ ਪਾਉਣਾ ਚਾਹੁੰਦੀ ਹਾਂ ਸਰ ਪਲੀਜ਼ ਇਹ ਪ੍ਰੋਡਕਟ ਮੇਰਾ ਨਾ ਰਿਟਰਨ ਕਰ ਦਿਉ ਜੋ ਕਿ ਮੇਰੇ ਪੈਸੇ ਬਚ ਸਕਣ ਅਤੇ ਇਸਦੀ ਸਰ ਮੈਂ ਹੋਰ ਵੀ ਕਾਫੀ ਪ੍ਰੋਡਕਟ ਪਰਚੇਸ ਕੀਤੇ ਸੀ ਤੁਹਾਡੇ ਕੰਪਨੀ ਤੋਂ ਅਤੇ ਉਹ ਮੈਨੂੰ ਵਧੀਆ ਆਏ ਨੇ ਸਿਰਫ ਆਹੀ ਪ੍ਰੋਡਕਟ ਮੈਨੂੰ ਵਧੀਆ ਨਹੀਂ ਨਿਕਲਿਆ ਇਸ ਲਈ ਜਿਹੜਾ ਮੇਰਾ ਮੈਂ ਇਹ ਪ੍ਰੋਡਕਟ ਰਿਟਰਨ ਕਰਨਾ ਚਾਹੁੰਦੀ ਹਾਂ ਮੈਨੂੰ ਪਸੰਦ ਨਹੀਂ ਆਇਆ